ਮੇਰੀ ਸਭ ਤੋਂ ਪਸੰਦੀਦਾ ਕਿਤਾਬ ਹੈ ਜੋ ਕਿ ਬਹੁਤ ਸਾਰੀਆਂ ਜਿਵੇਂ ਕੀ ਤੁਸੀਂ ਵੇੇਖ ਸਕਦੇ ਹੋ ਕਿ ਮਿਸਟੀਰੀਅਸ ਕਿਤਾਬਾਂ ਹੋ ਗਈਆਂ ਉਹਦੇ ਵਿੱਚ ਬਹੁਤ ਜ਼ਿਆਦਾ ਥ੍ਰਲ ਹੁੰਦਾ ਹੈ ਅਤੇ ਬਹੁਤ ਹੀ ਜ਼ਿਆਦਾ ਫਨ ਹੁੰਦਾ ਹੈ ਕਿ ਉਸ ਵਿੱਚ ਅਸੀਂ ਵੇਖ ਸਕਦੇ ਹਾਂ ਕਿ ਉਸ ਕਿਤਾਬ ਨੂੰ ਪੜ੍ਹ ਕੇ ਬਹੁਤ ਹੀ ਜ਼ਿਆਦਾ ਇਹ ਚੀਜ਼ ਹੁੰਦੀ ਹੈ ਕਿ ਉਸ ਦਾ ਕਿੱਲਰ ਕੌਣ ਹੈ ਅਤੇ ਅੱਗੇ ਦੀ ਸਟੋਰੀ ਕੀ ਹੈ ਅਤੇ ਉਸ ਬੰਦੇ ਦਾ ਕਤਲ ਕਿਵੇਂ ਹੋਇਆ ਅਤੇ ਉਸ ਦਾ ਕਾਤਲ ਕੌਣ ਸੀ ਇਹੋ ਜਿਹੀਆਂ ਕਿਤਾਬਾ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਹਨ ਅਤੇ ਜਿਵੇਂ ਕਿ ਹੋ ਗਿਆ ਕੋਮੇਡੀ ਆਲੀ ਕਿਤਾਬਾਂ ਜਿਵੇਂ ਜਿਹਦੇ ਵਿੱਚ ਕੋਮੇਡੀ ਕੀਤੀ ਜਾਂਦੀ ਆ ਅਤੇ ਤੁਸੀਂ ਵੇਖ ਸਕਦੇ ਹੋ ਉਹ ਇੱਕ ਕਾਰਨ ਹੈ ਕਿ ਲੋਕ ਉਸ ਕਿਤਾਬ ਨੂੰ ਪੜ੍ਹ ਕੇ ਬਹੁਤ ਹੀ ਜ਼ਿਆਦਾ ਹੱਸਦੇ ਹਨ ਅਤੇ ਕਈ ਲੋਕਾਂ ਨੂੰ ਉਹ ਕਿਤਾਬਾਂ ਵੀ ਬੜੀਆਂ ਪਸੰਦ ਹਨ ਅਤੇ ਕਈ ਸ਼ੋਅ ਵੀ ਆਉਂਦੇ ਹੈ ਟੀ ਵੀ 'ਤੇ ਜੋ ਕਿ ਕੋਮੇਡੀ ਵਾਲੇ ਹੁੰਦੇ ਹਨ ਅਤੇ ਉਹ ਲੋਕਾਂ ਨੂੰ ਉਸ ਬਾਰੇ ਵੀ ਬਹੁਤ ਪਸੰਦ ਹਨ